ਹੈਲੋ ਹਾਂਜੀ ਸਰ ਇਹ ਆਪਾਂ ਕਲੋਨੀ ਜਾਣਾ ਸੀ ਘਰ ਸ਼ਰਮਿਆਂ ਦੇ ਪ੍ਰੀਕਸ਼ਿਤ ਸ਼ਰਮਾ ਕਰਕੇ ਨਾਮ ਹੈ ਹਾਂਜੀ ਫਲੈਟ ਫਲੈਟ ਨੰਬਰ ਅਤੇ ਬਿਲਡਿੰਗ ਨਹੀਂ ਪਤਾ ਸਰ

ਨਹੀਂ ਪਹਿਲੀ ਵਾਰੀ ਆਇਆ ਜੀ ਹਾਂ ਨਹੀਂ ਫੋਨ ਨੰਬਰ ਤਾਂ ਨਹੀਂ ਹੈਗਾ ਪਰ ਉਹ ਜੀ ਮੈਨੂੰ ਉਹ ਦੱਸ ਰਹੇ ਸੀ ਕਿ ਉਹ ਟੈਂਥ ਫਲੋਰ 'ਤੇ ਰਹਿੰਦੇ ਨੇ ਮੈਨੂੰ ਬਸ ਇੰਨਾ ਪਤਾ ਹੈਗਾ ਤੁਸੀਂ ਵੇਖ ਲਓ ਕਿਸੇ ਰਜਿਸਟਰ ਵਿੱਚ ਹਾਂ ਕੋਈ ਬਿਲਡਿੰਗ ਹੋਈ ਜਿੱਦਾਂ ਟੈਂਥ ਦਸ ਫਲੋਰ ਹੋਣ ਹਾਂ ਇਹ ਸਰ ਤਿੰਨ ਕੁ ਲੋਕ ਨੇ ਉਹ ਉਹਨਾਂ ਦੀ ਵਾਇਫ ਅਤੇ ਉਹਨਾਂ ਦਾ ਬੇਟਾ ਵਾਇਫ ਦਾ ਨਾਮ ਉਹਨਾਂ ਦੇ ਬੇਟੇ ਦਾ ਨਾਮ ਤਾਂ ਦੱਸ ਦਿੰਦਾ ਰੋਹਿਤ ਸ਼ਰਮਾ ਹਾਂਜੀ ਅੱਛਾ ਟੈਂਥ ਫਲੋਰ 'ਤੇ ਹਾਂਜੀ ਟੈਂਥ ਫਲੋਰ ਟੈਂਥ ਫਲੋਰ 'ਤੇ

ਹਾਂਜੀ ਡੀ ਅਤੇ ਈ ਬਿਲਡਿੰਗ ਅਤੇ ਕਿੰਨੇ ਬੀ ਕਿੰਨੇ ਬੀ ਐੱਚ ਕੇ ਹੈਗਾ ਉਹ ਮੈਨੂੰ ਪਤਾ ਥਰੀ ਐੱਚ ਕੇ ਰਹਿੰਦੇ ਹੈ

ਠੀਕ ਹੈ ਜੀ ਫਿਰ ਉੱਧਰ ਜਾਣਾ ਠੀਕ ਹੈ ਸਰ ਥੈਂਕ ਯੂ